ਕਲਾਕਾਰ ਦੇ ਰੂਪ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ 'ਚੋਂ ਕੁਛ ਇਸ ਤਰ੍ਹਾਂ ਦੀਆਂ ਚੁਣੌਤੀਆਂ ਹਨ ਉਹਨਾਂ ਦੇ ਹੱਲ ਕਲਾ ਸਪਲਾਈ ਅਤੇ ਸਟੇਸ਼ਨਰੀ ਦੀ ਕਮੀ ਕਈ ਵਾਰ ਕਲਾ ਦੀ ਸਪਲਾਈ ਸਪਲਾਈਆਂ ਦੀ ਕਮੀ ਹੋ ਜਾਂਦੀ ਹੈ ਖਾਸ ਕਰਕੇ ਜਦੋਂ ਕੋਈ ਵਿਸ਼ੇਸ਼ ਪ੍ਰੋਜੈਕਟ ਚੱਲ ਰਿਹਾ ਹੋਵੇ ਇਸ ਮਸਲੇ ਨੂੰ ਹੱਲ ਕਰਨ ਲਈ ਮੈਂ ਪਹਿਲਾਂ ਤੋਂ ਹੀ ਸਪਲਾਈਆਂ ਦਾ ਸਟਾਕ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਜਦੋਂ ਵੀ ਕੋਈ ਵਿਸ਼ੇਸ਼ ਚੀਜ਼ ਖਤਮ ਹੋਣ ਵਾਲੀ ਹੋਵੇ ਤਾਂ ਮੈਂ ਪਹਿਲਾਂ ਹੀ ਮੰਗਵਾ ਲੈਂਦੀ ਹਾਂ ਕਈ ਵਾਰੀ ਸਰਕਾਰੀ ਜਾਂ ਗੈਰ ਸਰਕਾਰੀ ਸੰਗਠਨਾਂ ਤੋਂ ਵਿੱਤੀ ਸਹਾਇਤਾ ਵੀ ਮਿਲਦੀ ਹੈ ਉਸ ਦਾ ਵੀ ਲਾਭ ਲੈਂਦੇ ਹਾਂ ਪ੍ਰੇਰਨਾ ਦੀ ਕਮੀ ਕਲਾਕਾਰ ਦੇ ਰੂਪ ਵਿੱਚ ਕਈ ਵਾਰ ਪ੍ਰੇਰਨਾ ਦੀ ਕਮੀ ਮਹਿਸੂਸ ਹੁੰਦੀ ਹੈ ਇਸ ਨੂੰ ਹੱਲ ਕਰਨ ਲਈ ਮੈਂ ਨਵੇਂ ਨਵੇਂ ਥਾਵਾਂ 'ਤੇ ਸਫਰ ਕਰਦੀ ਹਾਂ ਕੁਝ ਨਵੀਆਂ ਕਿਤਾਬਾਂ ਪੜ੍ਹਨ

ਸਹਿਯੋਗੀਆਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੀ ਹਾਂ ਨਵੇਂ ਤਰੀਕੇ ਪ੍ਰੇਰਨਾ ਦਿੰਦੇ ਹੈ ਧਿਆਨ ਅਤੇ ਅਭਿਆਸ ਰੱਖਣ ਵਾਸਤੇ ਮਨ ਨਾਲ ਹੀ ਮਨ ਨੂੰ ਸ਼ਾਂਤ ਰੱਖਣ ਅਤੇ ਨਵੇਂ ਵਿਚਾਰ ਨੂੰ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ ਕਈ ਵਾਰ ਅਜਿਹੇ ਮੌਕਿਆਂ ਦੀ ਕਮੀ ਜਾਂ ਲੋਕਾਂ ਦੇ ਸਮਰਥਨ ਦੀ ਕਮੀ ਵੀ ਚੁਣੌਤੀ ਬਣ ਜਾਂਦੀ ਹੈ ਇਸ ਲਈ ਮੈਂ ਇਸ ਕਲਾ ਕਮਿਊਨਿਟੀ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਦੀ ਹਾਂ ਜਿਸ ਨਾਲ ਹੋਰ ਕਲਾਕਾਰਾਂ ਨਾਲ ਸਬੰਧ ਬਣਾਉਣ ਵਿੱਚ ਮਦਦ ਮਿਲਦੀ ਹੈ ਸ਼ੋਸ਼ਲ ਮੀਡੀਆ 'ਤੇ ਕਲਾ ਪ੍ਰਦਰਸ਼ਨੀਆਂ ਵਿੱਚ ਸ਼ਾਮਿਲ ਹੋਣ ਦੀ ਕਲਾ ਨੂੰ ਪ੍ਰਮੋਟ ਕਰਨਾ ਵੀ ਪ੍ਰਾਪਤ ਕਰਨ ਦਾ ਵਧੀਆ ਤਰੀਕਾ